ਹੈਲੋ ਸਤਿ ਸ਼੍ਰੀ ਅਕਾਲ ਜੀ ਫਲਿੱਪਕਾਟ ਤੋਂ ਗੱਲ ਕਰਦੇ ਹੋ ਹਾਂਜੀ ਮੈਂ ਨਾ ਇੱਕ ਪਾਰਸਲ ਔਡਰ ਕੀਤਾ ਸੀ ਤੁਹਾਡੇ ਤੋਂ ਅਤੇ ਉਹ ਮੋਬਾਈਲ ਫ਼ੋਨ ਸੀ ਅਤੇ ਜਦੋਂ ਮੈਨੂੰ ਡਿਲੀਵਰੀ ਬੋਏ ਨੇ ਮੈਨੂੰ ਫ਼ੋਨ ਕੀਤਾ ਤਾਂ ਉਹ ਮੇਰੇ ਐਡਰੈਸ 'ਤੇ ਨਹੀਂ ਪਹੁੰਚ ਰਿਹਾ ਅਤੇ ਫਿਰ ਉਸਨੇ ਮੈਨੂੰ ਐਬਯੁਜਿੰਗ ਗਲਤ ਲੈਗਵੇਂਜ ਵੀ ਯੂਜ਼ ਕੀਤੀ ਅਤੇ ਮੇਰੇ ਘਰ 'ਤੇ ਵੀ ਨਹੀਂ ਪਹੁੰਚਿਆ ਅਤੇ ਮੈਂ ਉਸਨੇ ਮੈਨੂੰ ਮੇਂਨ ਰੋਡ 'ਤੇ ਬੁਲਾਇਆ ਅਤੇ ਮੈਂ ਜਦੋਂ ਮੇਂਨ ਰੋਡ 'ਤੇ ਗਿਆ ਤਾਂ ਮੈਨੂੰ ਕੁਝ ਸਮਾਂ ਲੱਗ ਗਿਆ ਕਿਉਂਕਿ ਇਹ ਮੇਰਾ ਮੇਰੇ ਘਰ ਤੋਂ ਦੋ ਕਿਲੋਮੀਟਰ ਦੀ ਦੂਰੀ 'ਤੇ ਸੀ ਅਤੇ ਨਾ ਹੀ ਮੇਰੇ ਕੋਲ ਕੋਈ ਸਾਧਨ ਸੀ ਅਤੇ ਨਾ ਹੀ ਮੇਰੇ ਕੋਈ ਘਰ ਸੀ ਉਪਰ ਤੋਂ ਮੀਂਹ ਵੀ ਪੈ ਰਿਹਾ ਸੀ ਪਰ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਉਸਨੇ ਮੈਨੂੰ ਬਹੁਤ ਹੀ ਗਲਤ ਤਰੀਕੇ ਨਾਲ ਬੀਹੇਵ ਕੀਤਾ ਅਤੇ ਮੈਨੂੰ ਗਲਤ ਬੋਲਿਆ ਅਤੇ ਜਦੋਂ ਮੈਂ ਆਪਣਾ ਪਾਰਸਲ ਖੋਲ੍ਹਣ ਲੱਗਿਆ ਤਾਂ ਉਸਨੇ ਮੈਨੂੰ ਮੇਰੇ ਤੋਂ ਪਾਰਸਲ ਖੋਹ ਲਿਆ ਅਤੇ ਨਾ ਹੀ ਉਹਨੇ ਮੈਨੂੰ ਪਾਰਸਲ ਨੂੰ ਖੋਲ੍ਹਣ ਦਿੱਤਾ ਜਦੋਂ ਮੈਂ ਉਸਨੂੰ ਪੇਅਮੈਂਟ ਪੂਰੀ ਕੀਤੀ ਅਤੇ ਉਸ ਤੋਂ ਬਾਅਦ ਜਦੋਂ ਮੈਂ ਪਾਰਸਲ ਖੋਲ੍ਹਿਆ ਤਾਂ ਪਾਰਸਲ ਦੀ ਪੈਕਿੰਗ ਜਮ੍ਹਾਂ ਹੀ ਲੋਅ ਕੁਆਲਟੀ ਦੀ ਸੀ ਅਤੇ ਮੇਰੀ ਸਕਰੀਨ ਮੇਰੇ ਫ਼ੋਨ ਜਦੋਂ ਮੈਂ ਔਨ ਕੀਤਾ ਤਾਂ ਉਸਦੀ ਇੱਕ ਸਾਈਡ ਤੋਂ ਨੁਕਰ ਤੋਂ ਜਮ੍ਹਾ ਹੀ ਸਕਰੀਨ ਡੈਮੇਜ ਹੋਈ ਪਈ ਸੀ ਅਤੇ ਉਸਦੀ ਬੌਡੀ ਵੀ ਬਿਲਕੁਲ ਨੀਚੇ ਤੋਂ ਐਵੇਂ ਲੱਗਦਾ ਸੀ ਜਿਵੇਂ ਕੋਈ ਪੁਰਾਣਾ ਫ਼ੋਨ ਹੈਗਾ ਹੈ ਠੀਕ ਹੈ ਅਤੇ ਉਸ ਤੋਂ ਬਾਅਦ ਜਦੋਂ ਮੈਂ ਉਸਨੂੰ ਔਪਨ ਔਪਨ ਕਰਕੇ ਜਦੋਂ ਮੈਂ ਕੈਮਰਾ ਚਲਾਇਆ ਤਾਂ ਇਸਦਾ ਕੈਮਰਾ ਬਹੁਤ ਹੀ ਜ਼ਿਆਦਾ ਧੁੰਦਲਾ ਸੀ ਅਤੇ ਮੈਂ ਇਸਨੂੰ ਚੰਗੀ ਤਰ੍ਹਾਂ ਦੇਖਿਆ ਮੈਨੂੰ ਇਸ ਇੰਝ ਲੱਗਿਆ ਜਿਵੇਂ ਕਿ ਇਹ ਮੈਨੂੰ ਪੁਰਾਣਾ ਫ਼ੋਨ ਕਿਸੇ ਨੇ ਪੈਕ ਕਰਕੇ ਭੇਜਿਆ ਹੋਵੇ ਅਤੇ ਜੇ ਇਹ ਫ਼ੋਨ ਦੀ ਜਿਸਦੀ ਮੈਂ ਗੱਲ ਕੀਤੀ ਇਹ ਉਹ ਫ਼ੋਨ ਹੈ ਹੀ ਨਹੀਂ ਇਹ ਜਦ ਕਿ ਇਹ ਮੈਨੂੰ ਲੋਅ ਮਾਡਲ ਦਾ ਫ਼ੋਨ ਦੇ ਦਿੱਤਾ ਹੈਗਾ ਅਤੇ ਮੈਨੂੰ ਤੁਹਾਡੀ ਪਹਿਲ ਨਾ ਹੀ ਤੁਹਾਡੀ ਮੈਨੂੰ ਮੈਨੂੰ ਤੁਹਾਡਾ ਡਿਲੀਵਰੀ ਬੋਏ ਵਧੀਆ ਲੱਗਿਆ ਨਾ ਕਿਉਂਕਿ ਉਸਨੇ ਮੇਰੇ ਨਾਲ ਬਹੁਤ ਹੀ ਗਲਤ ਤਰੀਕੇ ਨਾਲ ਗੱਲ ਕੀਤੀ ਹੈ ਅਤੇ ਦੂਸਰੀ ਗੱਲ ਜਦੋਂ ਮੈਂ ਔਡਰ ਕੀਤਾ ਸੀ ਮੇਰਾ ਹਫ਼ਤਾ ਪਹਿਲਾਂ ਆਉਣਾ ਸੀ ਇਹ ਫ਼ੋਨ ਮੇਰਾ ਬਹੁਤ ਹੀ ਜ਼ਿਆਦਾ ਲੇਟ ਹੋ ਗਿਆ ਹੈ ਜੋ ਕਿ ਮੈਂ ਆਪਣੇ ਫਰੈਂਡ ਨੂੰ ਗਿਫ਼ਟ ਕਰਨਾ ਸੀ ਅਤੇ ਨਾ ਇਹ ਤਾਂ ਗਿਫਟ ਕਰਨ ਦੇ ਲਾਇਕ ਵੀ ਨਹੀਂ ਹੈਗਾ ਠੀਕ ਹੈ ਅਤੇ ਹੁਣ ਇਹ ਮੈਂ ਤੁਹਾਡੇ ਤੋਂ ਅੱਜ ਤੋਂ ਬਾਅਦ ਨਾ ਹੀ ਮੈਂ ਕੋਈ ਪਾਰਸਲ ਪਾਰਸਲ ਮੰਗਵਾਵਾਂਗੇ ਅਤੇ ਨਾ ਹੀ ਮੈਂ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਕਹਵਾਂਗਾ ਵੀ ਇੱਥੋਂ ਪਾਰਸਲ ਨਾ ਮਗਵਾਓ ਅਤੇ ਮੈਂ ਸ਼ੋਸ਼ਲ ਮੀਡੀਆ 'ਤੇ ਬੜਾ ਗਰੁੱਪ ਬਣਾ ਕੇ ਸਾਰੇ ਲੋਕਾਂ 'ਚ ਇਹ ਗੱਲ ਸ਼ੇਅਰ ਕਰਾਂਗਾ ਕਿ ਫਲਿੱਪਕਾਟ ਬਹੁਤ ਹੀ ਫ਼ਰੌਡ ਬਹੁਤ ਹੀ ਵੱਡਾ ਫਰੌਡ ਹੈ ਅਤੇ ਇਹ ਬਹੁਤ ਹੀ ਘਟੀਆ ਪ੍ਰੋਡਕਟ ਸੇਲ ਕਰਦਾ ਹੈ